ਲੌਕਡਾਊਨ ਵਿੱਚ ਅਸੀਂ ਘਰ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਜਿਵੇਂ ਟਿੱਕੀ ਕੁਲਚੇ ਕੇਕ ਰੱਸਗੁੱਲੇ ਤੇ ਜਲੇਬੀਆਂ ਇਹ ਅਸੀਂ ਘਰ ਹੀ ਬਣਾਏ ਸੀ ਕਿਉਂਕਿ ਸਾਨੂੰ ਬਾਹਰ ਕੁਛ ਨਹੀਂ ਸੀ ਮਿਲਦਾ ਦੁਕਾਨਾਂ ਬੰਦ ਹੋ ਚੁੱਕੀਆਂ ਸੀ ਇਸ ਲਈ ਅਸੀਂ ਘਰ ਹੀ ਸਾਰਾ ਕੁਛ ਬਣਾਉਂਦੇ ਸੀ ਇਹ ਬਣਾ ਕੇ ਸਾਨੂੰ ਬਹੁਤ ਵਧੀਆ ਲੱਗਦਾ ਸੀ ਅਤੇ ਬਹੁਤ ਮਜ਼ਾ ਆਉਂਦਾ ਸੀ ਸਾਨੂੰ ਬਣਾਉਣ ਵਿੱਚ ਅਸੀਂ ਇਹ ਸਾਰਾ ਕੁਛ ਆਪ ਹੀ ਬਣਾਉਂਦੇ ਸੀ ਅਤੇ ਬਹੁਤ ਮਜ਼ੇ ਨਾਲ ਖਾਂਦੇ ਸੀ ਇਹ ਬਹੁਤ ਹੀ ਸਵਾਦ ਲੱਗਦੇ ਸੀ ਅਤੇ ਇਹ ਬਹੁਤ ਹੀ ਸਵਾਦ ਬਣੇ ਸੀ